ਮੈਂ ਇਕ ਮਾਂ ਹਾਂ ਮੈਂ ਆਪਣੇ ਬੱਚਿਆਂ ਨੂੰ ਅਖਬਾਰ ਪੜਨ ਲਈ ਇਸ ਲਈ ਕਹਿੰਦੀ ਹਾਂ ਕੀ ਉਹਨਾਂ ਦੀ ਪੜਨ ਦੀ ਆਦਤ ਬਣ ਜਾਵੇ ਅਖਬਾਰ ਪੜਨ ਨਾਲ ਬੱਚੇ ਨੂੰ ਪਤਾ ਲੱਗਦਾ ਹੈ ਕਿ ਸਾਡੇ ਆਲੇ ਦੁਆਲੇ ਦੀਨ ਦੁਨੀਆ ਵਿੱਚ ਕੀ ਵਾਪਰ ਰਿਹਾ ਹੈ ਇਸ ਨਾਲ ਉਹਨਾਂ ਦੀ ਜਾਣਕਾਰੀ ਵੱਧਦੀ ਹੈ ਤੇ ਉਹਨਾਂ ਨੂੰ ਆਪਣੇ ਪੇਪਰਾਂ ਦੇ ਵਿੱਚ ਮਦਦ ਮਿਲਦੀ ਹੈ ਦੂਸਰਾ ਅਖਬਾਰ ਵਰਤੋਂ ਵਿੱਚ ਲਿਆਈ ਗਈ ਸ਼ਬਦਾਵਲੀ ਨੂੰ ਉਹਨਾਂ ਦੀ ਉਸ ਸ਼ਬਦ ਨੂੰ ਪੜ੍ਨ ਦਾ ਉਚਾਰਨ ਵੀ ਸਹੀ ਹੁੰਦਾ ਹੈ ਉਨਾਂ ਦੀ ਸ਼ਬਦਾਵਲੀ ਅੱਛੀ ਹੁੰਦੀ ਹੈ ਉਹਨਾਂ ਨੂੰ ਨਵੇਂ ਨਵੇਂ ਸ਼ਬਦਾਂ ਦਾ ਪਤਾ ਚੱਲਦਾ ਹੈ ਕਈ ਵਾਰ ਮੈਂ ਉਹਨਾਂ ਦੇ ਕੋਲ ਬੈਠ ਕੇ ਅਖਬਾਰ ਪੜਦੀ ਹਾਂ ਤੇ ਕਈ ਵਾਰ ਬੱਚੇ ਮੇਰੇ ਕੋਲ ਬੈਠ ਕੇ ਅਖਬਾਰ ਪੜਦੇ ਹਾਂ ਉਹਨਾਂ ਨੂੰ ਭਾਵਨਾ ਆਉਂਦੀ ਹੈ ਕਿ ਸਾਡੇ ਵੱਡੇ ਜੇ ਪੜਦੇ ਹਨ ਤਾਂ ਸਾਨੂੰ ਵੀ ਪੰਜਾ ਅਖਬਾਰ ਪੜ੍ਨ ਦਾ ਸ਼ੌਂਕ ਹੋਣਾ ਚਾਹੀਦਾ ਹੈ